ਹਾਂਜੀ ਮੈਂ ਰੇਡੀਓ ਤੇ ਖਬਰਾਂ ਸੁਣਨਾ ਬਹੁਤ ਪਸੰਦ ਕਰਦਾ ਹਾਂ ਕਿਉਂਕਿ ਮੈਂ ਆਪਣੇ ਆਲੇ ਦੁਆਲੇ ਵਿੱਚ ਚੱਲ ਰਹੀ ਆਂ ਗਤੀਆਂ ਵਿਧੀਆਂ ਬਾਰੇ ਜਾਣਨਾ ਪਸੰਦ ਕਰਦਾ ਹਾਂ ਮੈਂ ਜੋ ਰੇਡੀਓ ਉੱਤੇ ਚੈਨਲ ਫੋਲੋ ਕਰਦਾ ਹਾਂ ਉਸ ਵਿੱਚ ਸਭ ਤੋਂ ਪਹਿਲਾਂ ਆਕਾਸ਼ਬਾਣੀ ਨੰਬਰ ਦੂਜੇ ਤੇ ਜਲੰਧਰ ਤੀਜੇ ਤੇ ਆਲ ਇੰਡੀਆ ਚੌਥੇ ਤੇ ਡੀ ਡੀ ਨਿਊਜ਼ ਇਹ ਚੈਨਲ ਜੋ ਮੈਂ ਰੇਡੀਓ ਤੇ ਫੋਲੋ ਕਰਦਾ ਹਾਂ ਮੈਨੂੰ ਵੱਖ ਵੱਖ ਖਬਰਾਂ ਦੇ ਅਪਡੇਟ ਬਾਰੇ ਸੁਣ ਕੇ ਉਤਸ਼ਾਹ ਅਤੇ ਗਿਆਨ ਮਿਲਦਾ ਹੈ ਜੋ ਆਪਣੇ ਆਲੇ ਦੁਆਲੇ ਅਤੇ ਵਿਦੇਸ਼ਾਂ ਵਿੱਚ ਗਤੀਵਿਧੀਆਂ ਚੱਲ ਰਹੀਆਂ ਹਨ ਉਹਨਾਂ ਬਾਰੇ ਪਤਾ ਲੱਗਦਾ ਹੈ ਮੈਂ ਜਿਆਦਾਤਰ ਵਿਗਿਆਨ ਅਤੇ ਟੈਕਨੋਲਜੀ ਕਾਰੋਬਾਰ ਅਤੇ ਅਰਥ ਸ਼ਾਸਤਰ ਵਾਤਾਵਰਨ ਸਬੰਧੀ ਖੇਡਾਂ ਦੀਆਂ ਖਬਰਾਂ ਅਤੇ ਪ੍ਰੇਰਨਾਦਾਇਕ ਕਹਾਣੀਆਂ ਸੁਣਨਾ ਪਸੰਦ ਕਰਦਾ ਹਾਂ ਵਿਗਿਆਨ ਅਤੇ ਟੈਕਨੋਲਜੀ ਖਬਰਾਂ ਵਿੱਚ ਪੁਲਾੜ ਖੋਜ ਜਾਂ ਨਵੀਂ ਕੋਈ ਡਾਕਟਰੀ ਸਫਲਤਾ ਵਿੱਚ ਤਰੱਕੀ ਬਾਰੇ ਦੱਸਿਆ ਜਾਂਦਾ ਹੈ ਕਾਰੋਬਾਰ ਅਤੇ ਅਸਤ ਸ਼ਾਸਤਰ ਵਿੱਚ ਬਾਜ਼ਾਰਾਂ ਦੇ ਰੁਝਾਨ ਆਰਥਿਕ ਬਦਲਾਅ ਬਾਰੇ ਅਪਡੇਟ ਮਿਲਦੀ ਹੈ ਵਾਤਾਵਰਨ ਸਬੰਧੀ ਖਬਰਾਂ ਵਿੱਚ ਮੌਸਮ ਦੀ ਜਾਣਕਾਰੀ ਮਿਲਦੀ ਹੈ ਜਿਸ ਨੂੰ ਸੁਣ ਕੇ ਕੱਲ ਵਾਲੇ ਮੌਸਮ ਬਾਰੇ ਪਤਾ ਲੱਗਦਾ ਹੈ ਕਿ ਮੌਸਮ ਠੀਕ ਰਵੇਗਾ ਜਾਂ ਖਰਾਬ ਹੋਵੇਗਾ ਉਸ ਦੇ ਹਿਸਾਬ ਨਾਲ ਕੱਲ ਦਾ ਕੋਈ ਪ੍ਰੋਗਰਾਮ ਬਣਾਇਆ ਜਾ ਸਕਦਾ ਹੈ ਪ੍ਰੇਰਨਾਦਾਇਕ ਕਹਾਣੀਆਂ ਸੁਣ ਕੇ ਮੈਨੂੰ ਹਰ ਰੋਜ਼ ਨਵੇਂ ਨਾਇਕਾਂ ਭਾਈਚਾਰਕ ਪ੍ਰਤੀਆਂ ਬਾਰੇ ਪਤਾ ਲੱਗਦਾ ਹੈ ਅਤੇ ਉਹਨਾਂ ਨਾਇਕਾਂ ਦੀਆਂ ਕਹਾਣੀਆਂ ਸੁਣ ਕੇ ਮੈਨੂੰ ਉਤਸ਼ਾਹ ਮਿਲਦਾ ਹੈ ਮੇਰਾ ਹੌਸਲਾ ਵੱਧਦਾ ਹੈ ਖੇਡਾਂ ਦੀਆਂ ਖਬਰਾਂ ਸੁਣ ਕੇ ਸਰੀਰ ਕਸਰਤ ਕਰਨ ਲਈ ਤਿਆਰ ਹੁੰਦਾ ਹੈ ਜਿਸ ਨਾਲ ਸਿਹਤ ਤੰਦਰੁਸਤ ਵਧੀਆ ਰਹਿੰਦੀ ਹੈ ਕੁਝ ਉਦਾਹਰਨਾ ਹਨ ਜੋ ਮੈਂ ਖਬਰਾਂ ਜਾਂ ਚੈਨਲ ਦੱਸੇ ਹਨ ਇਹ ਕੁਝ ਉਦਾਹਰਨਾ ਹਨ ਪਰ ਮੈਂ ਹਮੇਸ਼ਾ ਖੇ ਵੱਖ ਵੱਖ ਖੇਤਰਾਂ ਵਿੱਚ ਨਵੇਂ ਅਤੇ ਦਿਲਚਸਪ ਵਿਕਾਸਾਂ ਬਾਰੇ ਸੁਣ ਲਈ ਉਤਸਾਹਿਤ ਰਹਿੰਦਾ ਹਾਂ ਇਹਨਾਂ ਖਬਰਾਂ ਦੇ ਅਪਡੇਟ ਨਾਲ ਮੈਂ ਕੋਈ ਨਵੇਂ ਕੰਮ ਨੂੰ ਕਰਨ ਲਈ ਉਤਸਾਹ ਉਤਸਾਹਿਤ ਹੁੰਦਾ ਹਾਂ ਅਤੇ ਮੇਰਾ ਮਨ ਇਕ ਨਵਾਂ ਕੰਮ ਕਰਕੇ ਚੰਗਾ ਮਹਿਸੂਸ ਕਰਦਾ ਹੈ ਧੰਨਵਾਦ